ਅਸੀਂ ਤਿਉਹਾਰਾਂ ਮੌਕੇ ਕਈ ਮੂਰਤੀਆਂ ਬਣਾਉਂਦੇ ਹਾਂ ਜਿਵੇਂ ਦੀਵਾਲੀ ਵੇਲੇ ਲਕਸ਼ਮੀ ਮਾਤਾ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਦੇ ਹਾਂ ਅਸੀਂ ਰੰਗ ਨਾਲ ਕੰਧ ਉੱਤੇ ਲਛਮੀ ਮਾਤਾ ਦੀ ਮੂਰਤੀ ਬਣਾਉਂਦੇ ਹਾਂ ਇਸ ਦਿਨ ਅਸੀਂ ਬਹੁਤ ਖੁਸ਼ ਹੁੰਦੇ ਹਾਂ ਅਤੇ ਪਟਾਕੇ ਮਿਠਾਈਆਂ ਆਦਿ ਲਿਆਉਂਦੇ ਹਾਂ ਜੋ ਲਸ਼ ਸਭ ਕੁਝ ਲਕਸ਼ਮੀ ਮਾਤਾ ਦੀ ਮੂਰਤੀ ਮੂਹਰੇ ਰੱਖ ਕੇ ਪੂਜਾ ਕਰਦੇ ਆ ਇੱਕ ਹੋਰ ਤਿਉਹਾਰ ਹੋਈ ਮਾਤਾ ਵੀ ਹੈ ਜੋ ਸਾਡੇ ਪੰਜਾਬ ਵਿੱਚ ਬਣਾਇਆ ਜਾਂਦਾ ਹੈ ਇਹ ਤਿਉਹਾਰ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਬਣਾਇਆ ਜਾਂਦਾ ਹੈ ਅਤੇ ਕੰਧ ਉੱਤੇ ਲਛਮੀ ਮਾਤਾ ਦੀ ਫੋਟੋ ਬਣਾਈ ਜਾਂਦੀ ਹੈ ਅਤੇ ਕਾਮਨਾ ਕੀਤੀ ਜਾਂਦੀ ਹੈ ਕਿ ਸਾਡੇ ਬੱਚੇ ਤੰਦਰੁਸਤ ਰਹਿਣ ਅਤੇ ਉਸ ਮੂਹਰੇ ਪਾਣੀ ਦਾ ਇੱਕ ਛੋਟਾ ਜਿਹਾ ਲੁੱਟਾ ਭਰ ਕੇ ਵੀ ਰੱਖਿਆ ਜਾਂਦਾ ਹੈ ਜੋ ਕਿ ਸੁੱਖ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ ਇਸ ਦਿਨ ਸਾਰੇ ਬੱਚੇ ਖੁਸ਼ ਹੁੰਦੇ ਹਨ ਅਤੇ ਅਸੀਂ ਵੀ ਇਸ ਮੂਰਤੀ ਨੂੰ ਬਣਾ ਕੇ ਬਹੁਤ ਖੁਸ਼ ਹੁੰਦੇ ਹਾਂ ਅਤੇ ਦੀਵਾਲੀ ਵੇਲੇ ਲਕਸ਼ਮੀ ਮਾਤਾ ਦੀ ਪੂਜਾ ਦੇ ਨਾਲ ਨਾਲ ਅਸੀਂ ਰੰਗੋਲੀ ਵੀ ਬਣਾਉਂਦੇ ਹਾਂ ਜੋ ਕਿ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਸ ਤਰ੍ਹਾਂ ਅਸੀਂ ਦੀਵਾਲੀ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਉਂਦੇ ਹਾਂ